ਮੈਂ ਅਲੱਗ ਅਲੱਗ ਤਰ੍ਹਾਂ ਦੇ ਖਾਣਾ ਬਣਾ ਲੈਂਦੀ ਹਾਂ ਜਿਸ ਤਰ੍ਹਾਂ ਕਿ ਆਲੂ ਦੇ ਪਰੋਂਠੇ ਮੱਕੀ ਦੀ ਰੋਟੀ 'ਚ ਵੀ ਮੈਂ ਆਲੂ ਭਰ ਕੇ ਪਰੋਂਠੇ ਬਣਾ ਲੈਂਦੀ ਜਦੋਂ ਮੇਰੇ ਘਰ ਕੋਈ ਗੈਸਟ ਆਉਂਦਾ ਅਤੇ ਉਹ ਪੁੱਛਦਾ ਕਿ ਹਾਂ ਦਵਿੰਦਰ ਇਹ ਕਿਵੇਂ ਬਣਾਏ ਉਹ ਖਾ ਕੇ ਕਹਿੰਦੇ ਵਾਹ ਇਹੋ ਜਿਹੀ ਚੀਜ਼ ਨਾ ਅਸੀਂ ਕਦੇ ਨਹੀਂ ਖਾਧੀ ਸੀਗੀ ਦਵਿੰਦਰ ਜਿਵੇਂ ਤੂੰ ਬਣਾਈ ਫਿਰ ਮੈਂ ਉਨ੍ਹਾਂ ਨੂੰ ਦੱਸਦੀ ਹਾਂ ਕਿ ਹਾਂ ਇਸ ਤਰ੍ਹਾਂ ਆਲੂ ਮੱਕੀ ਦਾ ਆਟਾ ਲੈ ਕੇ ਉਹਦਾ ਵੇੜ ਬਣਾ ਕੇ ਆਲੂ 'ਚ ਭਰ ਕੇ ਮੱਕੀ ਦੀ ਰੋਟੀ ਬਹੁਤ ਟੇਸਟੀ ਬਣਦੀ ਉਹ ਅਤੇ ਜਿਸ ਤਰ੍ਹਾਂ ਕਿ ਆਲੂ ਵਿੱਚ ਸ਼ੇਦ ਕੱਢ ਕੇ ਮੈਂ ਉਹ 'ਚ ਬੇਸਣ ਭਰ ਕੇ ਆਲੂ ਗੋਲ ਬਿਲਕੁਲ ਫਰਾਈ ਕਰਕੇ ਉਹ ਭਰ ਕੇ ਆਲੂ ਭੜਥਾ ਬਣਾਉਦੀ ਜਦੋਂ ਖਾ ਕੇ ਦੇ ਸਾਰੇ ਕਹਿੰਦੇ ਦਵਿੰਦਰ ਬਹੁਤ ਟੇਸਟੀ ਬਣਾਇਆ ਮੈਂ ਸਾਰਿਆਂ ਨੂੰ ਬਣਾ ਬਣਾ ਕੇ ਸਗੋਂ ਘਰ ਚੀਜ਼ਾਂ ਪੁਜਾਉਣੀਆਂ ਉਹਨੇ ਕਹਿਣਾ ਹਾਏ ਚੀਜ਼ ਬਣਾ ਕੇ ਦਵਿੰਦਰ ਸਾਨੂੰ ਦੇ ਕੇ ਜਾਈ ਜਿਹੜੀ ਵੀ ਚੀਜ਼ ਕਿਸੇ ਨੂੰ ਪਸੰਦ ਆਉਂਦੀ ਮੈਂ ਉਹ ਹੀ ਚੀਜ਼ ਬਣਾਉਦੀ ਹਾਂ ਭੜਥਾ ਹੋ ਗਿਆ ਕਿਸੇ ਨੂੰ ਕੋਈ ਵੀ ਚੀਜ਼ ਪਸੰਦ ਆਏ ਮੈਂ ਅਗਲੇ ਦੇ ਘਰ ਚੀਜ਼ ਦੇ ਕੇ ਆਉਣੀ ਕਿ ਦਵਿੰਦਰ ਕੋਈ ਨਾ ਮੈਂ ਘਰ ਅਗਲੇ ਨੂੰ ਬੁਲਾਉਂਦੀ ਆਲੂ ਦਾ ਪਰੋਂਠਾ ਹੋ ਗਿਆ ਮੱਕੀ ਦੀ ਰੋਟੀ ਹੋ ਗਈ ਜਿਸ ਤਰ੍ਹਾਂ ਕੋਈ ਵੀ ਚੀਜ਼ ਟੇਸਟੀ ਬਣਦੀ ਤਾਂ ਅਗਲੇ ਸਾਰੇ ਆ ਕੇ ਮੇਰੀ ਤਰੀਫ਼ ਕਰਦੇ ਕਹੋਗੇ ਦਵਿੰਦਰ ਆਪਣੀ ਆਂਟੀ ਨੂੰ ਵੀ ਸਿਖਾਈ ਸਾਡੇ ਬੱਚਿਆਂ ਨੂੰ ਵੀ ਸਾਡੇ ਬੱਚਿਆਂ ਨੂੰ ਤਾਂ ਚੀਜ਼ ਆਉਂਦੀ ਨਹੀਂ ਹੈ ਨਾ ਤੂੰ ਪਤਾ ਨਹੀਂ ਕਿਵੇਂ ਬਣਾ ਲੈਂਦੀ ਤੇਰੀ ਆਂਟੀ ਨੂੰ ਤਾਂ ਇਹ ਚੀਜ਼ ਆਈ ਨਹੀਂ ਬਿਲਕੁਲ ਵੀ ਬਣਾਉਣੀ ਫਿਰ ਮੈਂ ਉਹ ਦੱਸਦੀ ਹੁੰਦੀ ਕੋਈ ਨਾ ਮੈਂ ਆ ਆ ਕੇ ਉਨ੍ਹਾਂ ਦੇ ਘਰ ਜਾ ਕੇ ਹੈਲਪ ਕਰਕੇ ਉਨ੍ਹਾਂ ਦੀ ਉਨ੍ਹਾਂ ਨੂੰ ਇੱਕ ਦੋ ਵਾਰ ਬਣਾ ਕੇ ਦੱਸ ਦਿੰਦੀ ਫਿਰ ਉਹਨਾਂ ਨੂੰ ਵੀ ਉਹ ਚੀਜ਼ ਆ ਜਾਂਦੀ ਬਣਾਉਣੀ ਫਿਰ ਉਹ ਕਹਿੰਦੇ ਦਵਿੰਦਰ ਬਾਈ ਤੂੰ ਤੇਰੇ ਵਰਗੇ ਠੀਕ ਹੈ ਤੂੰ ਇੰਨੀ ਵਧੀਆ ਬਣਾਉਦੀ ਇੱਦਾਂ ਕੋਈ ਚੀਜ਼ ਸਾਨੂੰ ਕੋਈ ਨਹੀਂ ਸਿਖਾਉਂਦਾ ਕਿ ਹਾਏ ਤੈਨੂੰ ਹਰੇਕ ਚੀਜ਼ ਬਣਾਉਣੀ ਆਉਂਦੀ